ਭੰਗੜਾ ਇੱਕ ਡਾਂਸ ਫੋਰਮ ਹੈ ਜੋ ਇਸ ਦੀਆਂ ਬਹੁਤ ਊਰਜਾਵਾਨ ਅਤੇ ਉਤਸ਼ਾਹੀ ਚਾਲਾਂ ਲਈ ਪ੍ਰਸਿੱਧ ਹੈ ਡਾਂਸ ਕਸਰਤ ਵਿੱਚ ਲਗਾਤਾਰ ਅਤੇ ਤਾਲਬੱਧ ਅੰਦੋਲਨ ਸ਼ਾਮਿਲ ਹੁੰਦੇ ਹਨ ਇਸ ਤਰ੍ਹਾਂ ਇਸ ਨੂੰ ਤੁਹਾਡੇ ਸਰੀਰ ਲਈ ਇੱਕ ਵਧੀਆ ਐਰੋਬਿਕ ਕਸਰਤ ਬਣਾਉਣਾ ਇਹ ਤੁਹਾਡੀਆਂ ਬਾਹਾਂ ਕੁੱਲੇ ਅਤੇ ਲੱਤਾਂ ਦੀਆਂ ਮਾਂਸਪੇਸ਼ੀਆਂ ਨੂੰ ਟੋਨ ਕਰਨ ਵਿੱਚ ਵੀ ਮਦਦ ਕਰਦਾ ਹੈ